ਪੰਜਾਬ ਵਿੱਚ ਇੱਕ ਧਰਮ ਦੇ ਲੋਕ ਨਹੀਂ ਰਹਿੰਦੇ ਇੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਨਾਲ਼ ਨਾਲ਼ ਰਹਿੰਦੇ ਨੇ ਜਿਵੇਂ ਸਿੱਖ ਧਰਮ ਦੇ ਨਾਲ਼ ਹਿੰਦੂ ਧਰਮ ਦੇ ਲੋਕ ਮੁਸਲਮਾਨ ਈਸਾਈ ਜੈਨ ਸਾਰੇ ਧਰਮਾਂ ਦੇ ਲੋਕ ਸਾਨੂੰ ਇੱਥੇ ਮਿਲ ਜਾਂਦੇ ਨੇ ਅਤੇ ਉਹ ਸਾਰਿਆਂ ਨਾਲ਼ ਇੱਕ ਦੂਜੇ ਨਾਲ਼ ਮਿਲ ਕੇ ਰਹਿੰਦੇ ਨੇ ਅਤੇ ਇੱਕ ਦੂਜੇ ਦੇ ਵਿੱਚ ਸਹਿਯੋਗ ਵੀ ਕਰਦੇ ਨੇ